ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਅੱਛਾ ਜੀ ਕਦੋਂ ਆਉਣਾ ਚਾਹੁੰਦੇ ਹੋ ਜੀ ਹਾਂਜੀ ਪਹਿਲਾਂ ਤਾਂ ਮੈਨੂੰ ਇੱਥੇ ਜਿਹੜਾ ਇਹ ਫਤਿਹਗੜ੍ਹ ਸਾਹਿਬ ਆ ਅਤੇ ਮਾਤਾ ਗੁਜਰੀ ਇਹਦਾ ਇਤਿਹਾਸ ਇਹ ਆ ਵੀ ਇਹ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਇੱਥੇ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਅਤੇ ਇੱਥੇ ਮੁਗਲ ਸਾਮਰਾਜ ਦੇ ਮਤਲਬ ਜਿਵੇਂ ਓਤ ਉਦੋਂ ਦੇ ਓਤ ਓਮ ਓ ਜਿਵੇਂ ਉੱਥੋਂ ਦੇ ਲੋਕ ਰਹਿੰਦੇ ਸੀ ਹੈ ਨਾ ਉੱਥੇ ਇੱਕ ਆਮ ਖਾਸ ਬਾਗ ਬਣਿਆ ਹੋਇਆ ਜਿੱਥੇ ਪੁਰਾਣਾ ਆਰਕੀਟੈਕਚਰ ਯੂਜ਼ ਹੋਇਆ ਹੋਇਆ ਵੀ ਹਾਂ ਅਲੱਗ ਅਲੱਗ ਤਰ੍ਹਾਂ ਦੇ ਫੁਆਰੇ ਲੱਗੇ ਹੋਏ ਨੇ ਅਤੇ ਬਿਲਡਿੰਗਜ਼ ਬਣੀਆਂ ਹੋਈਆਂ ਨੇ ਅਤੇ ਇਹਦੇ ਇਲਾਵਾ ਇੱਥੇ ਇੱਕ ਮੋਤੀ ਮਹਿਰਾ ਜੀ ਦਾ ਗੁਰਦੁਆਰਾ ਸਾਹਿਬ ਆ ਅਤੇ ਬਹੁਤ ਵੱਡੀ ਪਾਰਕ ਵੀ ਬਣੀ ਹੋਈ ਹੈ ਜਿੱਥੇ ਲੋਕ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਅਤੇ ਹੁਣ ਦੇ ਟਾਈਮ ਵਿੱਚ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਕਿਉਂਕਿ ਇਹ ਸ਼ਹੀਦੀ ਦਿਨ ਚੱਲਦੇ ਨੇ ਅਤੇ ਇਹ ਸ਼ਹੀਦੀ ਦਿਹਾੜਾ ਇੱਥੇ ਮਨਾਉਂਦੇ ਨੇ ਇੱਥੇ ਇੱਕ ਤਿੰਨ ਚਾਰ ਕੋਲਜ ਵੀ ਨੇ ਜਿਵੇਂ ਕਿ ਇੱਕ ਮਾਤਾ ਗੁਜਰੀ ਕੋਲਜ ਹੈ ਇੱਕ ਬਾਬਾ ਬੰਦਾ ਸਿੰਘ ਬਹਾਦਰ ਯੂਨੀਵਰਸਿਟੀ ਹੈ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਹੈ ਇੱਕ ਲਿੰਕਲਨ ਕੋਲਜ ਹੈ ਏ ਇੱਥੇ ਵੀ ਬਹੁਤ ਤਰ੍ਹਾਂ ਦੇ ਮਿਊਜ਼ੀਅਮ ਬਣੇ ਹੋਏ ਨੇ ਜਿੱਥੇ ਵੀ ਮਤਲਬ ਪੁਰਾਣੀਆਂ ਚੀਜ਼ਾਂ ਨੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਰਿਲੇਟਿਡ ਬਹੁਤ ਜ਼ਿਆਦਾ ਬੁੱਕਸ ਪਈਆਂ ਨੇ ਇਹ ਟੂਰਿਸਟ ਨੂੰ ਫਰੀ ਮਤਲਬ ਕੋਈ ਇਹਨਾਂ ਦਾ ਚਾਰਜ ਨਹੀਂ ਹੁੰਦਾ ਬਸ ਇੱਕ ਸਕਿਓਰਟੀ ਫੀਸ ਰੱਖਦੇ ਨੇ ਆਪਣੀ ਬੁੱਕਸ ਲਈ ਅਤੇ ਫਰੀ ਬੁੱਕਸ ਪੜ੍ਹਾਉਂਦੇ ਨੇ ਤੇ ਇਹਦੇ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਮੈਨੂੰ ਦੱਸ ਦਿਓ ਜਦੋਂ ਆਉਣਾ ਹੋਇਆ ਮੈਂ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਦੇ ਦਾਂਗੀ ਥੈਂਕ ਯੂ